ਹਾਲੀਆ ਸਮੇਂ ਵਿੱਚ ਲੋਕਾਂ ਤੱਕ ਪਹੁੰਚ ਕਰਨ ਦੇ ਕਈ ਤਰੀਕੇ ਹਨ ਇਨ੍ਹਾਂ ਵਿੱਚੋਂ ਕੁਝ ਮੁੱਖ ਤਰੀਕੇ ਹਨ ਸੋਸ਼ਲ ਮੀਡੀਆ ਐਡਵਰਟਾਈਜ਼ਿੰਗ ਫੇਸਬੁੱਕ ਇੰਸਟਾਗ੍ਰਾਮ ਟਵੀਟਰ ਅਤੇ ਲਿੰਕਡਇਨ ਵਰਗੀਆਂ ਸੋਸ਼ਲ ਮੀਡੀਆ ਪਲੈਟਫੋਮਾਂ 'ਤੇ ਵੀਜਨ ਕਰਨਾ ਉਸ ਤੋਂ ਬਾਅਦ ਗੂਗਲ ਐਡਵਰਟਾਈਜ਼ਿੰਗ ਗੂਗਲ ਸੇਲਸ ਅਤੇ ਡਿਸਪਲੇ ਐਡਵਰਟਾਈਜ਼ਿੰਗ ਦੁਆਰਾ ਟਾਰਗੈਟ ਐਡਵਰਟਾਈਜ਼ਿੰਗ ਕਰਨਾ ਈਮੇਲ ਮਾਰਕੀਟਿੰਗ ਨਿਯਮਿਤ ਈਮੇਲ ਜਾਂ ਵੈਬਸਾਈਟ ਤੋਂ ਨਿਊਜ਼ ਕਲੈਕਟ ਕਰਕੇ ਭੇਜ ਕੇ ਗਾਹਕਾਂ ਤੱਕ ਪਹੁੰਚ ਕਰਨਾ ਸੰਬੰਧਿਤ ਵਲੋਗ ਅਤੇ ਵੀਡੀਓਸ ਰਾਹੀਂ ਉਤਪਾਦ ਜਾਂ ਸੇਵਾਵਾਂ ਦਾ ਪ੍ਰਚਾਰ ਕਰਨਾ ਸਥਾਨਕ ਈਵੈਂਟਸ ਅਤੇ ਸਪੋਂਸਰਸ਼ਿਪ ਕਰਨਾ ਵਿੱਚ ਲੋਕਾਂ ਤੱਕ ਪਹੁੰਚਣਾ ਇਹ ਤਰੀਕੇ ਵਰਤ ਕੇ ਤੁਸੀਂ ਆਪਣੇ ਬ੍ਰੈਂਡ ਦੀ ਪਹੁੰਚ ਨੂੰ ਵਧਾ ਸਕਦੇ ਹੋਂ ਇਨ੍ਹਾਂ ਵਿੱਚੋਂ ਮੇਰੀ ਪਸੰਦੀਦਾ ਐਡਵਰਟਾਈਜ਼ਿੰਗ ਸੋਸ਼ਲ ਮੀਡੀਆ ਐਡਵਰਟਾਈਜ਼ਿੰਗ ਹੈ ਇਨ੍ਹਾਂ ਵਿੱਚ ਪੇਡ ਐਡਸ ਫੇਸਬੁੱਕ ਇੰਸਟਾਗ੍ਰਾਮ ਟਵੀਟਰਸ 'ਤੇ ਪੇਡ ਐਡਵਰਟਾਈਜ਼ਿੰਗ ਦੁਆਰਾ ਨਿਸ਼ਾਨਾ ਗ੍ਰਾਹਕਾਂ ਨੂੰ ਪਹੁੰਚਾਉਣਾ ਇਹ ਆਮ ਤੌਰ 'ਤੇ ਸਮਾਟ ਟਾਰਗੀਟਿੰਗ ਅਤੇ ਪੇਡ ਕਮਿਸ਼ਨ ਰਾਹੀਂ ਕੀਤਾ ਜਾਂਦਾ ਹੈ ਬੂਸਟਡ ਪੋਸਟ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਪੈਸੇ ਦੇ ਕੇ ਉਤਸ਼ਾਹਿਤ ਕਰਨਾ ਤਾਂ ਜੋ ਉਹ ਵਧੇਰੇ ਲੋਕਾਂ ਤੱਕ ਪਹੁੰਚ ਸਕਣ ਇੰਫਲੂਐਂਸਰ ਮਾਰਕਿਟ ਸੋਸ਼ਲ ਮੀਡੀਆ 'ਤੇ ਪ੍ਰਭਾਵਸ਼ਾਲੀ ਲੋਕਾਂ ਨਾਲ ਸਾਂਝਾ ਕਰਕੇ ਉਨ੍ਹਾਂ ਦੇ ਫਾਲੋਅਰਸ ਨੂੰ ਆਪਣੇ ਉਤਪਾਦਾਂ ਅਤੇ ਸੇਵਾਵਾਂ ਬਾਰੇ ਜਾਣੂ ਕਰਵਾਉਣਾ ਸਟੋਰੀਸ ਐਂਡ ਰੀਲਸ ਦੇ ਨਾਲ ਤੁਸੀਂ ਆਪਣਾ ਇੱਕ ਸੰਦੇਸ਼ ਪਹੁੰਚਾ ਸਕਦੇ ਹੋਂ ਟਾਰਗਿਟਿਡ ਐਡਵਰਟਾਈਜ਼ਿੰਗ ਜੋ ਕਿ ਵਿਸ਼ੇਸ਼ ਰੂਪ ਵਿੱਚ ਐਡਵਰਟਾਈਜ਼ਿੰਗ ਉਮਰ ਜਾਤੀ ਇੰਟਰਨੈੱਟ ਸਥਾਨ ਆਧਾਰਿਤ ਖਾਸ ਸਮੂਹਾਂ ਨੂੰ ਟਾਰਗਿਟ ਕਰਦੀ ਹੈ ਇਹ ਤਰੀਕੇ ਉਪਯੋਗ ਕਰਕੇ ਤੁਹਾਡੇ ਇਸ਼ਤਿਹਾਰ ਲਗਭਗ ਹਰ ਤਰ੍ਹਾਂ ਦੇ ਲੋਕਾਂ ਤੱਕ ਪਹੁੰਚ ਸਕਦੇ ਹਨ